ਨਮਸਕਾਰ ਜੀ ਨਮਸਕਾਰ ਸਰ ਮੋਬਾਇਲ ਲੈਣਾ ਸੀ ਆਪਾਂ ਇੱਕ ਆਪਣੇ ਕੋਲੇ ਕਿਹੜੇ ਕਿਹੜੇ ਹੈਗੇ ਹੈ ਮੋਬਾਇਲ ਅੱਛਾ ਜੀ ਵੀਵੋ ਵੀ ਹੋਊਗਾ ਅੱਛਾ ਜੀ ਅੱਛਾ ਜੀ ਅਤੇ ਵਨਪਲੱਸ ਹੈਗਾ ਜੀ ਉਹ ਅੱਛਾ ਜੀ ਅਤੇ ਆਪਾਂ ਨੂੰ ਨਾ ਘੱਟੋ ਘੱਟ ਛੇ ਜੀਬੀ ਰੈਮ ਆ ਮਤਲਬ ਉਦੂ ਬਾਅਦ ਚੌਂਹਠ ਜਾਂ ਇੱਕ ਸੌ ਅਠਾਈ ਜੀਬੀ ਉਹ ਦੂਜਾ ਚਾਹੀਦਾ ਆਪਾਂ ਨੂੰ ਫੋਨ ਆਲਾ ਅਤੇ ਸਰ ਕਿੰਨੇ ਤੋਂ ਸਟਾਰਟ ਆ ਮੋਬਾਇਲ ਲਾਈਫ ਕਿੰਨੇ ਤੋਂ ਸਟਾਰਟ ਆ ਠੀਕ ਹੈ ਜੀ ਅਠਾਰਾਂ ਹਜ਼ਾਰ ਤੋਂ ਸਟਾਰਟ ਹੈ ਅੱਛਾ ਜੀ ਅਤੇ ਤੁਹਾਡੇ ਹਿਸਾਬ ਨਾਲ ਕਿਹੜਾ ਵਧੀਆ ਰਹੂਗਾ ਮੋਬਾਇਲ ਓਪੋ ਵੀਵੋ ਜਾਂ ਮਤਲਬ ਸੈਮਸੰਗ ਇਹਨਾਂ 'ਚੋਂ ਅੱਛਾ ਹਾਂ ਉਹਦੀ ਡਿਮਾਂਡ ਜ਼ਿਆਦਾ ਹੈਗੀ ਹੈ ਅੱਛਾ ਜੀ ਠੀਕ ਹੈ ਜੀ ਠੀਕ ਹੈ ਇਹ ਹੈਂਗ ਹੂੰਗ ਤਾਂ ਨਹੀਂ ਹੁੰਦਾ ਜੀ ਅੱਛਾ ਜੀ ਠੀਕ ਹੈ ਜੀ ਸਰ ਡਿਸਕਾਊਟ ਕਿੰਨਾ ਮਤਲਬ ਆਪਾਂ ਨੂੰ ਨਹੀਂ ਸਰ ਐਂਏ ਨਾ ਕਰੋ ਥੋੜ੍ਹਾ ਜਿਹਾ ਨਾ ਵੱਧ ਕਰੋ ਕਿਉਂਕੀ ਦੀਵਾਲੀ 'ਤੇ ਸੇਲ ਆਈ ਸੀ ਉੱਥੇ ਚਾਲੀ ਪਰਸੈਂਟ ਓਫ ਸੀਗਾ ਜੀ ਓਨਲਾਈਨ 'ਤੇ ਅੱਛਾ ਜੀ ਥੋੜ੍ਹਾ ਜਿਹਾ ਕਰ ਦਿਉ ਨਾ ਵੱਧ ਫਿਰ ਉਹ ਵਨਪਲੱਸ ਲੈ ਲਵਾਂਗੇ ਨਾ ਦੇਖਲੋ ਮਾੜਾ ਜਿਹਾ ਹੁੰਦਾ

ਚਲੋ ਥੋੜ੍ਹਾ ਜਿਹਾ ਕਰ ਦਿੰਦੇ ਨਾ ਤਾਂ ਸਹੀ ਸੀਗਾ ਅੱਛਾ ਜੀ ਚਲੋ ਕੋਈ ਗੱਲ ਨਹੀਂ ਸਰ ਅਤੇ ਸਰ ਮ ਮੋਬਾਇਲ ਦੇ ਨਾਲ ਕੀ ਕੀ ਆਊਗਾ ਚਾਰਜਰ ਵਗੈਰਾ ਆਊਗਾ ਅੱਛਾ ਜੀ ਹੋਰ ਇਹਦੇ ਨਾਲ ਕੀ ਹੁੰਦਾ ਆਪਾਂ ਨੂੰ ਅੱਛਾ ਜੀ ਠੀਕ ਹੈ ਜੀ ਸਰ ਵਾਰੰਟੀ ਕਿੰਨੇ ਸਾਲ ਦੀ ਹੈ ਠੀਕ ਕਵਰ ਠੀਕ ਹੈ ਜੀ ਠੀਕ ਹੈ ਵਨ ਈਅਰ ਵਰੰਟੀ ਹੈ ਠੀਕ ਹੈ ਜੀ ਠੀਕ ਹੈ ਜੀ ਅਤੇ ਸਰ ਮੰਨ ਲਓ ਵੀ ਕੋਈ ਦਿੱਕਤ ਨਹੀਂ ਆਉਂਦੀ ਸੋਫਟਵੇਅਰ ਵਗੈਰਾ ਕਿਸ ਚੀਜ਼ ਦੀ ਫੋਲਡਰ ਵਗੈਰਾ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਅਤੇ ਸਰ ਤੁਸੀਂ ਵਾਰੰਟੀ 'ਚ ਮਤਲਬ ਆਹ ਕਰਾ ਮੋਬਾਇਲ ਬਦਲ ਕੇ ਦਉਂਗੇ ਜਾਂ ਮਤਲਬ ਉਸੇ ਨੂੰ ਠੀਕ ਕਰਵਾ ਕੇ ਦਉਂਗੇ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਪੀਸ ਬਦਲ ਕੇ ਦਉਂਗੇ ਪੰਦਰਾਂ ਦਿਨਾਂ 'ਚ ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ ਉਹ ਤੁਸੀਂ ਕੰਪਨੀ ਨੂੰ ਮਤਲਬ ਵਾਪਿਸ ਦੇ ਦਓਗੇ ਉਹ ਰਿਪੇਅਰ ਕਰਕੇ ਭੇਜ ਦੇਣਗੇ ਠੀਕ ਹੈ ਜੀ ਠੀਕ ਆ ਅੱਛਾ ਠੀਕ ਹੈ ਚਲੋ ਵਨਪਲੱਸ ਲੈ ਲਵਾਂਗੇ ਫਿਰ ਠੀਕ ਹੈ ਜੀ ਥੋੜ੍ਹਾ ਜਿਹਾ ਨਾ ਰੇਟ ਜੇ ਲਾ ਲਿਓ ਆਪਾਂ ਵਨਪਲੱਸ ਹੀ ਲੈ ਲਵਾਂਗੇ ਫਿਰ ਠੀਕ ਹੈ ਜੀ ਮਿਹਰਬਾਨੀ ਜੀ